ਨੌ ਜਨਵਰੀ ਉੱਨੀ ਸੌੌ ਪੰਤਾਲੀ ਸੌੌਲਾਂ ਮਾਰਚ ਉੱਨੀ ਸੌੌ ਪੰਝੱਤਰ ਤੇਈ ਜੂਨ ਉੱਨੀ ਸੌੌ ਪਚਾਸੀ ਅਠਾਈ ਜੁਲਾਈ ਉੱਨੀ ਸੌ ਨੜਿਨਵੇਂ ਤੀਹ ਸਤੰਬਰ ਦੋੋ ਹਜ਼ਾਰ